ਸਰਕਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਪਰਾਧ ਘਟਾਉਣ ਲਈ ਕੋਈ ਕਦਮ ਨਹੀਂ ਚੁੱਕ ਰਹੀ ਸਰਕਾਰਾਂ ਤੋਂ ਸਾਨੂੰ ਹੁਣ ਬਹੁਤੀ ਆਸ ਨਹੀਂ ਰਹੀ ਨਸ਼ਿਆਂ ਨਾਲ ਮਰ ਰਹੇ ਸਾਡੇ ਪੁੱਤਾਂ ਦੇ ਸਿਵੇ ਲਟਾ ਲਟ ਮੱਚ ਰਹੇ ਹਨ ਅਤੇ ਮਾਵਾਂ ਵਿਲਕ ਰਹੀਆਂ ਹਨ ਬਦਕਿਸਮਤੀ ਨਾਲ ਜਿਹੜੇ ਨਸ਼ਾ ਵੇਚਦੇ ਹਨ ਉਹ ਹੀ ਸਾਡੇ ਹੀ ਵੀ ਸਾਡੇ ਹੀ ਹਨ ਇਹ ਦਰਦ ਭਰੇ ਸ਼ਬਦ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਪਿੰਡ ਘੱਲ ਕਲਾਂ ਦੀ ਵਸਨੀਕ ਗਿੰਦਰਪਾਲ ਕੌਰ ਦੇ ਹਨ ਗਿੰਦਰਪਾਲ ਕੌਰ ਸਾਬਕਾ ਸਰਪੰਚ ਹਨ ਅਤੇ ਸਾਡੇ ਪਿੰਡ ਵਿੱਚ ਬਣਾਏ ਗਏ ਸਮਾਜ ਸੁਧਾਰ ਕਮੇਟੀ ਸਰਗਰਮ ਮੈਂਬਰ ਹਨ ਇਹ ਦਰਦ ਇਕੱਲੇ ਇਹਨਾਂ ਦੇ ਨਹੀਂ ਪੰਜਾਬ ਦੇ ਪਿੰਡਾਂ ਵਿੱਚ ਪਿਛਲੇ ਇੱਕ ਮਹੀਨੇ ਦੌਰਾਨ ਬਣੀਆਂ ਨਸ਼ਾ ਵਿਰੋਧੀ ਕਮੇਟੀਆਂ ਵਿੱਚ ਸ਼ਾਮਿਲ ਹੋਣ ਵਾਲੀ ਹਰ ਔਰਤ ਦੇ ਮਨ ਦਾ ਦਰਦ ਗਿੰਦਰਪਾਲ ਕੌਰ ਵਰਗਾ ਵੀ ਹੈ ਨਸ਼ੇ ਵਾਲੇ ਟੀਕਿਆਂ ਦਾ ਅਤੇ ਘੋੜਾ ਕੈਪਸੂਲ ਕਈ ਥਾਵਾਂ 'ਤੇ ਨੌਜਵਾਨਾਂ ਨਸ਼ਿਆਂ ਦੀ ਗੱਲ ਪੰਜਾਬ ਦੇ ਹਰ ਖਿੱਤੇ ਵਿੱਚ ਚੱਲ ਰਹੀ ਅਤੇ ਖ਼ਾਸ ਕਰਕੇ ਚਿੱਟੇ ਦੀ ਇਸ ਤੋਂ ਇਲਾਵਾ ਮੈਡੀਕਲ ਨਸ਼ਿਆਂ ਵਿਰੋਧ ਵੀ ਲੋਕਾਂ ਵੱਲ ਕੀਤੀ ਜਾ ਰਹੀ ਹੈ ਲਾਮਬੰਦੀ 'ਤੇ ਜਿਕਰਯੋਗ ਹੈ